ਮੈਂ ਆਪਣਾ ਆ ਆਪ ਨੂੰ ਸਿਹਤਮੰਦ ਰੱਖਣ ਲਈ ਮੈਂ ਸਵੇਰੇ ਉੱਠ ਕੇ ਮੈਦਾਨ 'ਚ ਜਾਂਦਾ ਹਾਂ ਦੌੜ ਲਾਉਣ ਦੀ ਅਤੇ ਸ਼ਾਮੀ ਜਿਮ ਜਾਂਦਾ ਹਾਂ ਅਤੇ ਹਲਕੀ ਕਸਰਤ ਕਰਦਾ ਹਾਂ ਅਤੇ ਇਹਨਾਂ ਕਰਕੇ ਮੇਰੀ ਮਾਸ਼ਪੇਸ਼ੀਆਂ ਮਜ਼ਬੂਤ ਹੁੰਦੀਆਂ ਅਤੇ ਇਹਦੇ ਨਾਲ ਹੀ ਮੈਂ ਕਦੇ ਕਦੇ ਸਾਈਕਲ ਵੀ ਚਲਾ ਲੈਂਦਾ ਹਾਂ ਅਤੇ ਮੈਡੀਟੇਸ਼ਨ ਵੀ ਕਰਦਾ ਇੱਕ ਗੱਲ ਇਹ ਹੈਗੀ ਆ ਕਿ ਦੌੜਨ ਭੱਜਣ ਨਾਲ ਮੇਰੀ ਸਰੀਰਿਕ ਸਿਹਤ ਤਾਂ ਮਜ਼ਬੂਤ ਹੁੰਦੀ ਹੁੰਦੀ ਹੈ ਪਰ ਨਾਲ ਨਾਲ ਮੇਰੀ ਜੋ ਭਾਵਨਾਤਮਕ ਅੰਦਰੂਨੀ ਦਿਮਾਗੀ ਉਹ ਮਜ਼ਬੂਤੀ ਵੀ ਹੁੰਦੀ ਹੈ ਫਿਰ ਮੈਂ ਕਰਦਾ ਬਈ ਆਪਣੇ ਛੋਟੀ ਛੋਟੀਆਂ ਗਤੀਵਿਧੀਆਂ ਜਿਵੇਂ ਕਿ ਜਿਹੜੇ ਕੰਮ 'ਚ ਆਪਣਾ ਮਨ ਲੱਗੇਗਾ ਜਿਵੇਂ ਮੈਂ ਡਰਾਇੰਗ ਕਰਦਾ ਹਾਂ ਤਾਂ ਮੈਂ ਉਹ ਕਰ ਲੈਂਦਾ ਹਾਂ ਨਾਲੇ ਮੈਂ ਕੋਸ਼ਿਸ਼ ਕਰਦਾ ਕਿ ਵੀ ਕੁਦਰਤ ਦੇ ਨੇੜੇ ਵੱਧ ਤੋਂ ਵੱਧ ਸਮਾਂ ਬਿਤਾਓ ਇਹਦੀ ਕੋਸ਼ਿਸ਼ ਕਰਦਾ ਹਾਂ ਮੈਂ ਕਸਰਤ ਅਤੇ ਜੋ ਜੋਗਿੰਗ ਮੇਰੀ ਸਰੀਰਕ ਸਿਹਤ ਨੂੰ ਮਜ਼ਬੂਤ ਕਰਦੀਆਂ ਅਤੇ ਮੇਰੀ ਮਾਨਸਿਕ ਸਿਹਤ ਨੂੰ ਵੀ ਚੰਗੀ ਰੱਖਦੀਆਂ ਸਾਰਾ ਤਨਾਅ ਦੂਰ ਹੋਣ ਕਰ ਦਿੰਦੀਆਂ ਯਾਰ